ਮੇਰੀ ਪਸੰਦ ਸਾਹਿਤਕਾਰ ਅੰਮ੍ਰਿਤਾ ਪ੍ਰੀਤਮ ਹੈ ਉਹਨਾਂ ਦਾ ਜਨਮ ਇਕੱਤੀ ਅਗਸਤ ਉੱਨੀ ਸੌ ਉੱਨੀ ਨੂੰ ਗੁਜਰਾਂਵਾਲਾ ਪਾਕਿਸਤਾਨ ਵਿੱਚ ਹੋਇਆ ਉਹਨਾਂ ਦੀ ਛਿਆਸੀ ਸਾਲ ਦੀ ਉਮਰ 'ਚ ਦਿੱਲੀ ਵਿੱਚ ਮੌਤ ਹੋ ਗਈ ਸੀ ਉਹਨਾਂ ਦੇ ਪਤੀ ਦਾ ਨਾਂ ਪ੍ਰੀਤਮ ਸਿੰਘ ਸੀ ਉਹਨਾਂ ਦੇ ਤਿੰਨ ਬੱਚੇ ਸਨ ਉਹਨਾਂ ਨੂੰ ਕਈ ਅਵਾਰਡ ਵੀ ਮਿਲੇ ਜਿੰਨਾ ਚੋਂ ਜੀ ਸਾਇਨ ਅਵਾਰਡ ਜਨਪਿਥ ਅਵਾਰਡ ਪਦਮ ਸ਼੍ਰੀ ਅਵਾਰਡ

ਜੋ ਉਹਨਾਂ ਨੂੰ ਸਾਹਿਤਕਾਰੀ ਕਰ ਕਾਰਨਾਂ ਕਰਕੇ ਮਿਲੇ ਸਾਨੂੰ ਉਹਨਾਂ ਦੀਆਂ ਕਵਿਤਾਵਾਂ ਚੋਂ ਇਹ ਸਿੱਖਿਆ ਮਿਲਦੀ ਹੈ ਕਿ ਹਮੇਸ਼ਾ ਜ਼ਿੰਦਗੀ ਵਿੱਚ ਰੁਕਣਾ ਨਹੀਂ ਚਾਹੀਦਾ ਅਤੇ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ ਉਂਝ ਤਾਂ ਮੈਨੂੰ ਸਭ ਕਵਿਤਾਵਾਂ ਉਹਨਾਂ ਦੀਆਂ ਚੰਗੀਆਂ ਲੱਗਦੀਆਂ ਹਨ ਪਰ ਇੱਕ ਮੁਲਾਕਾਤ ਬਹੁਤ ਪਸੰਦ ਹੈ